ਸਾਡਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਬਹੁਤ ਹੀ ਧਾਰਮਿਕ ਅਸਥਾਨ ਹੈ ਜਿੱਥੇ ਕਿ ਛੋਟੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਅਤੇ ਇੱਥੇ ਧਾਰਮਿਕ ਇਹਨਾਂ ਦੇ ਨਾਂ 'ਤੇ ਹੀ ਕਿ ਯੂਨੀਵਰਸਿਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਯੂਨੀਵਰਸਿਟੀ ਬਣਾਈ ਗਈ ਹੈ ਉੱਥੇ ਬਾਬਾ ਬੰਦਾ ਬਹਾਦਰ ਸਿੰਘ ਇਜੀਨੀਅਰ ਕਾਲਜ ਬਣਾਇਆ ਗਿਆ ਹੈ ਅਤੇ ਮਾਤਾ ਗੁਜਰ ਕੌਰ ਦੇ ਨਾਂ 'ਤੇ ਸਕੂਲ ਕਾਲਜ ਬਣਾਏ ਗਏ ਹਨ ਤਾਂ ਜੋ ਇੱਥੇ ਸਾਰੇ ਹੀ ਬੱਚੇ ਵਧੀਆ ਪੜ੍ਹਾਈ ਕਰਕੇ ਚੰਗੀ ਸਿੱਖਿਆ ਪ੍ਰਾਪਤ ਕਰਕੇ ਚੰਗੇ ਚੰਗੇ ਅਹੁਦਿਆਂ 'ਤੇ ਚੰਗੀ ਚੰਗੀਆਂ ਨੌਕਰੀਆਂ ਕਰਦੇ ਹਨ ਅਤੇ ਲਿੰਕਨ ਕਾਲਜ ਵੀ ਇੱਥੇ ਹੈ ਜਿੱਥੇ ਲੋਕ ਬੀ ਐੱਲ ਐੱਲ ਬੀ ਕਰਕੇ ਚੰਗੇ ਵਕੀਲ ਬਣਦੇ ਨੇ ਅਤੇ ਕਿਤੇ ਵੀ ਜਾਣ ਦੀ ਜ਼ਰੂਰਤ ਬਾਹਰ ਕੋਚਿੰਗ ਲੈਣ ਦੀ ਜ਼ਰੂਰਤ ਨਹੀਂ ਪੈਂਦੀ ਇੱਥੇ ਹੀ ਚੰਗੀਆਂ ਕੋਚਾਂ ਕਲਾਸਾਂ ਬੱਚਿਆਂ ਨੂੰ ਮਿਲਦੀਆਂ ਹਨ